ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਡੀ ਸ਼ੋਪ 'ਤੇ ਆਉਣਾ ਸੀਗਾ ਜੁੱਤੀਆਂ ਲੈਣ ਹਾਂਜੀ ਸਰ ਤੁਸੀਂ ਦੱਸ ਸਕਦੇ ਹੋ ਵੀ ਤੁਹਾਡੇ ਕੋਲ਼ ਕਿਹੜੀਆਂ ਕਿਹੜੀਆਂ ਜੁੱਤੀਆਂ ਹੈਗੀਆਂ ਹਾਂਜੀ ਇਹਨਾਂ ਦਾ ਪ੍ਰਾਈਜ਼ ਕਿੰਨਾ ਵਾ ਪੰਜਾਬੀ ਜੁੱਤੀ ਤੋਂ ਸਟਾਰਟਿੰਗ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਦੇ ਪ੍ਰਾਈਜ਼ ਸਲੀਪਰ ਦਾ ਪ੍ਰਾਈਜ਼ ਕੀ ਹੈ ਠੀਕ ਹੈ ਅਤੇ ਤੁਹਾਡੇ ਕੋਲ਼ ਬੋਆਇਜ ਦੇ ਵੀ ਸ਼ੂਜ਼ ਵਗੈਰਾ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮੈਂ ਕੱਲ੍ਹ ਆ ਜਾਂਦੀ ਹਾਂ ਸਤਿ ਸ਼੍ਰੀ ਅਕਾਲ ਥੈਂਕ ਯੂ